ਸਤਿ ਸ਼੍ਰੀ ਅਕਾਲ ਵਿਦੇਸ਼ੀ ਸਮੱਗਰੀ ਜੋ ਮੈਂ ਕਈ ਵਾਰ ਖਾਣੇ ਵਿੱਚ ਇਸਤੇਮਾਲ ਕਰਦੀ ਆਪਣੇ ਮੰਮੀ ਪਾਪਾ ਦੀ ਵਧੀਆ ਸਿਹਤ ਲਈ ਉਹ ਹੈਗਾ ਕੋਈਨੀਆ ਮੈਂ ਕੋਈਨੀਆ ਦਾ ਖੁੱਲੀਆ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਦੱਸਦੀ ਹਾਂ ਕੋਈਨੀਆ ਹੁੰਦਾ ਕੀ ਆ ਕੋਈਨੀਆ ਇੱਕ ਛੋਟਾ ਬੀਜ ਵਾਲਾ ਅੰਨ ਹੈ ਜਿਹੜਾ ਅੱਧਾ ਤਰੇ ਤੋਂ ਵਿਟਕ ਮਿਲਦੇ ਹੈਗੇ ਹਾਂ ਇਹ ਇੱਕ ਖੁਸ਼ਬੂ ਜਵਾਰ ਹੈ ਜੋ ਜੁੱਤੀਆਂ ਵੱਜਣ ਵਾਲੇ ਲੋਕਾਂ ਲਈ ਲਈ ਫਾਇਦੇਮੰਦ ਹੁੰਦਾ ਹੈ ਇਹ ਵਿਸ਼ੇਸ਼ ਰੂਪ ਨਾਲ਼ ਜੋ ਸਬਜ਼ੀਆਂ ਖਾਂਦੇ ਉਹਨਾਂ ਲਈ ਉੱਤਮ ਪ੍ਰੋਟੀਨ ਦਾ ਸਰੋਤ ਹੈ ਇਸ ਦਾ ਸੇਵਨ ਪ੍ਰੋਟੀਨ ਫ਼ਾਈਬਰ ਵਿਟਾਮਿਨ ਅਤੇ ਖ਼ਾਸ ਕਰ ਆਇਰਨ ਦੀ ਭਰਪੂਰ ਹੁੰਦਾ ਜੋ ਸਿਹਤ ਬਰਾਬਰੀ ਵਿੱਚ ਨਾਸ਼ਤਾ ਬਣਿਆਣ ਲਈ ਉਪਯੋਗ ਹੋ ਸਕਦਾ ਹੈ ਅੱਜ ਮੈਂ ਤੁਹਾਨੂੰ ਆਪਣੀ ਇੱਕ ਇਜ਼ੀ ਰੈਸਪੀ ਦੱਸਦੀ ਹਾਂ ਕਿ ਮੈਂ ਕਿੱਦਾਂ ਕੋਈਨੀਆ ਦਾ ਖੁੱਲ੍ਹੀਆ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਕੋਈਨੀਆ ਲੈਂਦੀ ਹਾਂ ਇੱਕ ਕੱਪ ਉਹਨੂੰ ਫਿਰ ਧੋ ਲੈਂਦੀ ਹਾਂ ਧੋਣ ਤੋਂ ਬਾਅਦ ਸਾਫ਼ ਪਾਣੀ 'ਚ ਧੋਣ ਤੋਂ ਬਾਅਦ ਪਾਣੀ 'ਚ ਪਾਣੀ ਨੂੰ ਦੋ ਕੱਪ ਪਾਣੀ ਨੂੰ ਉਬਾਲਦੀ ਹਾਂ ਜਦ ਪਾਣੀ ਉਬਲ ਜਾਂਦਾ ਫਿਰ ਉਹਦੇ 'ਚ ਕੋਈਨੀਆਂ ਪਾ ਕੇ ਨਮਕ ਪਾ ਕੇ ਰੱਖ ਦਿੰਦੀ ਹਾਂ ਪੰਦਰਾਂ ਵੀਹ ਮਿੰਟ ਲਈ ਜਦੋਂ ਕੋਈਨੀਆ ਧੀਰੇ ਧੀਰੇ ਉਹ ਗਲ਼ਣ ਲੱਗ ਜਾਂਦਾ ਹੈ ਉਹਨੂੰ ਦੇਖਦੀ ਹਾਂ ਦਬਾ ਕੇ ਕੀ ਗਲ਼ ਗਿਆ ਜਾਂ ਨਹੀਂ ਗਲ਼ਿਆ ਜਦੋਂ ਉਹ ਪੂਰੀ ਤਰੀਕੇ ਨਾਲ਼ ਸੌਖ ਲੈਂਦਾ ਹੈ ਫਿਰ ਉਹਦੇ ਬਾਅਦ ਮੈਂ ਤੇਲ ਲੈਂਦੀ ਹਾਂ ਗਰਮ ਕਰਦੀ ਹਾਂ ਅਤੇ ਉਬਲੇ ਹੋਏ ਆਪਣੇ ਕੋਈਨੀਆ ਨੂੰ ਧੀਰੇ ਧੀਰੇ ਨਾਲ਼ ਭੁੰਨ ਲੈਂਦੀ ਹਾਂ ਜਦੋਂ ਕੋਈਨੀਆ ਕ੍ਰਿਸਪੀ ਹੋ ਜਾਂਦਾ ਵਧੀਆ ਹੋ ਜਾਂਦਾ ਫਿਰ ਇਹਨੂੰ ਮੈਂ ਸਲਾਦ 'ਚ ਪਾ ਕੇ ਸਬਜ਼ੀਆਂ ਦੇ ਨਾਲ਼ ਪਾ ਕੇ ਆਪਣੀ ਮੰਮੀ ਪਾਪਾ ਨੂੰ ਦਿੰਦੀ ਹਾਂ ਕਾਲੀ ਮਿਰਚਾਂ ਵੀ ਜੇ ਅਸੀਂ ਪਾ ਦਈਏ ਤਾਂ ਉਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਇਹ ਮੇਰੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਏਗਾ ਜੇ ਅੱਜ ਕੱਲ੍ਹ ਲੋਕ ਇਸਤੇਮਾਲ ਕਰੇ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੁੰਦੀ ਆ ਧੰਨਵਾਦ ਜੀ